ਹਾਂਜੀ ਮਾਰਸ਼ਲ ਆਰਟਸ ਨੇ ਨਾ ਮੇਰੇ ਵਿੱਚ ਇਕਾਗਰਤਾ ਦੇ ਪੱਧਰ ਨੂੰ ਕਾਫੀ ਜ਼ਿਆਦਾ ਸੁਧਾਰਿਆ ਹੈਗਾ ਇਹਨੇ ਪੜ੍ਹਾਈ ਦੇ ਵਿੱਚ ਵੀ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਸੀ ਇਹਦੇ ਵਿੱਚ ਨਾ ਇੱਕ ਵੱਖਰੀ ਚੀਜ਼ ਹੈ ਵੀ ਨਾ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਰੱਖਦਾ ਹੈਗਾ ਜਿਵੇਂ ਜਿਵੇਂ ਅਸੀਂ ਇਹਦਾ ਅਭਿਆਸ ਕਰਦੇ ਹਾਂ ਨਾ ਇਹ ਸਾਨੂੰ ਜਿਹੜਾ ਕੀ ਹੈ ਸਾਡੇ ਸਰੀਰ ਦੇ ਸਾਡੇ ਮਨ ਨੂੰ ਜਿਹੜਾ ਕੀ ਹੈ ਇੱਕ ਕੰਮ 'ਤੇ ਕੇਂਦਰਿਤ ਕਰਨ ਦੀ ਜਿਹੜੀ ਲੋੜ ਹੁੰਦੀ ਹੈ ਨਾ ਉਹ ਮੈਨੂੰ ਨਾ ਇਸ ਮਾਰਸ਼ਲ ਆਰਟਸ ਨੇ ਹੀ ਮੈਨੂੰ ਸਿਖਾਈ ਵੀ ਕਿਵੇਂ ਆਪਦਾ ਧਿਆਨ ਮੈਂ ਕੇਂਦਰਿਤ ਕਰ ਸਕਦਾ ਹੈਗਾ ਜਦੋਂ ਮੈਂ ਆਪਦਾ ਧਿਆਨ ਕੇਂਦਰਿਤ ਕਰਨ ਲੱਗਿਆ ਤਾਂ ਮੇਰੀ ਪੜ੍ਹਾਈ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਇਹਨੇ ਮੇਰੀ ਮਦਦ ਕੀਤੀ ਤਾਂ ਉਹ ਫਿਰ ਆਪਾਂ ਉਸ ਜਿਹੜੇ ਕੰਮ ਨੂੰ ਆਪਾਂ ਕਰਨ ਲੱਗ ਜਾਦੇ ਹਾਂ ਨਾ ਮਨ ਲਾ ਕੇ ਤਾਂ ਉਹ ਫਿਰ ਵਧੀਆ ਹੀ ਕਾਮਯਾਬ ਹੁੰਦਾ ਫਿਰ ਇਹਨੇ ਮੇਰੇ ਵਿੱਚ ਸਬਰ ਅਤੇ ਲਗਨ ਦੀ ਜਿਹੜੀ ਭਾਵਨਾ ਹੈਗੀ ਉਹ ਵੀ ਮੇਰੇ ਵਿੱਚ ਆਈ ਠੀਕ ਹੈ ਇਹਦੇ ਵਿੱਚ ਕੀ ਹੈ ਮੈਨੂੰ ਜਿਹੜਾ ਸਿੱਖਣ ਦੇ ਵਿੱਚ ਜਿਹੜਾ ਸਮਾਂ ਅਤੇ ਲਗਨ ਲੱਗਦੀ ਹੈ ਨਾ ਇਹ ਵਿਸ਼ੇਸ਼ਤਾਵਾਂ ਜਿਹੜੀਆਂ ਹੈਗੀਆਂ ਇਹ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਹੋਈਆਂ ਮੇਰੀਆਂ ਭਾਵੇਂ ਜਿਹੜਾ ਵਿਸ਼ਾ ਮੇਰਾ ਕੋਈ ਵੀ ਔਖਾ ਹੋ ਸਕਦਾ ਸੀ ਜਿਵੇਂ ਮੈਥ ਹੈਗਾ ਤਾਂ ਉਹਦੇ ਲਈ ਮੈਨੂੰ ਸਬਰ ਦੀ ਲੋੜ ਸੀਗੀ ਤਾਂ ਉਹ ਵੀ ਮੈਨੂੰ ਇਸ ਚੀਜ਼ ਤੋਂ ਜਿਹੜਾ ਸਿੱਖਣ ਨੂੰ ਜਿਹੜਾ ਮਿਲਿਆ ਅਤੇ ਉਸ ਤੋਂ ਇਲਾਵਾ ਇਹਨੇ ਕੀ ਹੈ ਪੜ੍ਹਾਈ ਦੇ ਵਿੱਚ ਜਿਹੜਾ ਕਿ ਆਪਾਂ ਕਈ ਵਾਰ ਤਨਾਵ ਲੈ ਜਾਂਦੇ ਹਾਂ ਠੀਕ ਹੈ ਤਾਂ ਇਹ ਮੇਰਾ ਤਨਾਅ ਘਟਾਉਣ ਦੇ ਵਿੱਚ ਵੀ ਇਸ ਚੀਜ਼ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਤਾਂ ਕਿ ਮੈਂ ਜਿਹੜਾ ਸ਼ਾਂਤ ਮਨ ਦੇ ਨਾਲ ਜਿਹੜੀ ਆਪਦੀ ਪੜ੍ਹਾਈ ਕਰਦਾ ਰਿਹਾ ਸੀਗਾ ਕਿਉਂਕਿ ਸ਼ਾਂਤ ਮਨ ਦੇ ਨਾਲ ਕੀਤੀ ਹੋਈ ਜਿਹੜੀ ਪੜ੍ਹਾਈ ਸੀਗੀ ਨਾ ਉਹ ਹਮੇਸ਼ਾ ਵਧੀਆ ਹੀ ਹੁੰਦੀ ਹੈਗੀ ਅਤੇ ਉਸ ਤੋਂ ਇਲਾਵਾ ਮਾਰਸ਼ਲ ਆਰਟਸ ਨੇ ਨਾ ਮੇਰੇ ਵਿੱਚ ਆਤਮ ਵਿਸ਼ਵਾਸ਼ ਬਹੁਤ ਵਧਾਇਆ ਸੀਗਾ ਇਹ ਆਤਮ ਵਿਸ਼ਵਾਸ ਵਧਣ ਦੇ ਨਾਲ ਹੀ ਜਿਹੜਾ ਮੈਂ ਪੜ੍ਹਾਈ ਦੇ ਵਿੱਚ ਸਫਲ ਹੋ ਸਕਿਆ ਅਤੇ ਜਿਹੜਾ ਕੀ ਹੈ ਅਤੇ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਵੀ ਆਪਾਂ ਸਾਰਿਆਂ ਨੂੰ ਜਿਹੜੇ ਕਿ ਮਾਰਸ਼ਲ ਆਰਟਸ ਦੀ ਜਿਹੜੀ ਟ੍ਰੇਨਿੰਗ ਲੈਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਜੀਵਨ ਦੇ ਵਿੱਚ ਸਫਲ ਹੋ ਸਕੀਏ